ਸਤਿ ਸ਼੍ਰੀ ਅਕਾਲ ਜੀ ਮੈਂ ਵਿਪਨ ਕੁਮਾਰ ਬੋਲ ਰਿਹਾ ਮੈਂ ਨਾ ਤੁਹਾਡੇ ਗਿਰਧਾਰੀ ਢਾਬੇ 'ਤੇ ਦਾਲ ਮੱਖਣੀ ਇਹ ਸ਼ਾਹੀ ਪਨੀਰ ਸਲਾਦ ਅਤੇ ਨਾਲ ਚਾਰ ਰੋਟੀਆਂ ਦਾ ਔਡਰ ਦਿੱਤਾ ਸੀਗਾ ਪਰ ਕਿਸੇ ਕਾਰਨ ਕਰਕੇ ਮੈਨੂੰ ਨਵਾਂਸ਼ਹਿਰ ਤੋਂ ਬਾਹਰ ਜਾਣਾ ਪੈ ਗਿਆ ਅਤੇ ਰੋਟੀ ਉੱਥੇ ਹੀ ਆ ਵੀ ਜਿਹੜੇ ਮੈਂ ਤੁਹਾਨੂੰ ਪੈਸੇ ਔਨਲਾਈਨ ਪੇਮੈਂਟ ਕਰ ਚੁੱਕਾ ਹਾਂ ਤੁਸੀਂ ਉਹ ਮੇਰੇ ਪੇਮੈਂਟ ਮੇਰੇ ਔਨਲਾਈਨ ਮੈਨੂੰ ਟਰਾਂ ਟਰਾਂਸਫਰ ਕਰ ਦਈਓ ਅਤੇ ਜਿਹੜਾ ਸਾਡਾ ਔਡਰ ਆ ਤੁਹਾਡਾ ਖਾਣਾ ਬਹੁਤ ਅੱਜ ਭਾਗਾਂ 'ਚ ਹੈ ਨਹੀਂ ਸੀਗਾ ਪਰ ਅਗਲੀ ਵਾਰ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਮੈਂ ਖਾਣਾ ਤੁਹਾਡੇ ਆ ਹਾ ਢਾਬੇ 'ਤੇ ਹੀ ਖਾਵਾਂਗਾ ਅਤੇ ਉੱਥੋਂ ਹੀ ਮੰਗਾਵਾਂਗਾ ਤਾਂ ਇਸ ਵਾਰ ਮੇਰਾ ਔਡਰ ਜਿਹੜਾ ਹੈ ਉਹ ਰੱਦ ਕਰ ਦਿੱਤਾ ਜਾਵੇ